ਜਦੋਂ ਵੀ ਚਿੱਤਰਕਾਰੀ ਸ਼ੁਰੂ ਕਰਨੀ ਚਾਹੀਦੀ ਹੈ ਤਾਂ ਪੁਰਾਣੇ ਚਿੱਤਰਕਾਰਾਂ ਤੋਂ ਸੇਧ ਲੈ ਲੈਣੀ ਚਾਹੀਦੀ ਹੈ ਕਿ ਚਿੱਤਰਕਾਰੀ ਕਿਵੇਂ ਸ਼ੁਰੂ ਕਰਨੀ ਹੈ ਅਤੇ ਉਨ੍ਹਾਂ ਦੇ ਰਾਹ 'ਤੇ ਚੱਲਦਿਆਂ ਹੋਇਆਂ ਚਿੱਤਰਕਾਰੀ ਸਿੱਖਣੀ ਚਾਹੀਦੀ ਹੈ